ਗੱਲ ਕਰੀਏ ਪਸ਼ੂਆਂ ਤੋਂ ਫਸਲਾਂ ਦੀ ਰਾਖੀ ਕਿਵੇਂ ਕਰੀ ਜਾਵੇ ਦੇਖੋ ਅੱਜ ਦੇ ਟਾਈਮ ਵਿੱਚ ਜੋ ਵੀ ਅਵਾਰਾ ਪਸ਼ੂ ਨੇ ਜਿਵੇਂ ਕਿ ਗੱਲ ਕਰ ਲਈਏ ਨੀਲ ਗਊਆਂ ਗਊਆਂ ਸਾਨ੍ਹ ਜੋ ਕਿ ਅਵਾਰਾ ਫਿਰਦੇ ਨੇ ਉਨ੍ਹਾਂ ਨੇ ਬਹੁਤ ਖੇਤਾਂ ਨੂੰ ਨੁਕਸਾਨ ਕੀਤਾ ਹੈ ਇਸ ਦੇ ਬਚਾਅ ਲਈ ਆਪਾਂ ਇੱਕ ਲੋਹੇ ਦੀ ਤਾਰ ਆਉਂਦੀ ਹੈ ਉਹ ਤੋਂ ਵਾੜ ਲਾ ਸਕਦੇ ਹਾਂ ਜਾਂ ਫਿਰ ਲੱਕੜ ਦੀ ਵਾੜ ਕਰ ਸਕਦੇ ਹਾਂ ਅਤੇ ਜਿੱਥੋਂ ਤੱਕ ਉਪਰਾਲਾ ਹੋ ਸਕੇ ਆਪਾਂ ਵੱਧ ਤੋਂ ਵੱਧ ਕਰ ਸਕੀਏ ਕਿ ਆਪਣੀ ਫਸਲ ਨੂੰ ਬਚਾਅ ਸਕੀਏ ਤੁਹਾਨੂੰ ਵੀ ਪਤਾ ਹੈ ਕਿ ਜਿਵੇਂ ਆਪਣਾ ਅਵਾਰਾ ਪਸ਼ੂ ਦਿਨ ਵਿੱਚ ਰਾਤ ਨੂੰ ਫਸਲਾਂ ਦਾ ਨੁਕਸਾਨ ਕਰਦੇ ਹਨ ਉਹ ਦੀ ਭਰਪਾਈ ਬਹੁਤ ਹੀ ਮਹਿੰਗੀ ਪੈਂਦੀ ਹੈ ਕਿਸਾਨ ਨੂੰ ਅਤੇ ਉਹ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਤਾਰ ਲਾ ਕੇ ਜਾਂ ਵਾੜ ਲਾ ਕੇ ਕਿਸੇ ਵੀ ਤਰ੍ਹਾਂ ਅਵਾਰਾ ਪਸ਼ੂਆਂ ਤੋਂ ਬਚਾਅ ਕਰ ਸਕੀਏ